ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਕਸਿਤ ਹੋ ਗਈਆਂ ਹਨ ਜਿਨ੍ਹਾਂ ਨੇ ਪੰਜਾਬੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਅੰਗਰੇਜ਼ੀ ਭਾਸ਼ਾ ਅੰਗਰੇਜ਼ੀ ਭਾਸ਼ਾ ਪੰਜਾਬ ਦੀ ਭਾਸ਼ਾ ਨਹੀਂ ਹੈ ਦ ਇਹ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਜੋ ਕਿ ਅੱਜ ਕੱਲ੍ਹ ਹਰ ਇਨਸਾਨ ਬੋਲਣ ਨੂੰ ਤਰਜੀਹ ਦੇ ਰਿਹਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹੀ ਇਸ ਭਾਸ਼ਾ ਨੂੰ ਬਹੁਤ ਜ਼ਿਆਦਾ ਸਨਮਾਨ ਦੇ ਰਹੇ ਹਨ ਜੇ ਅਸੀਂ ਗੱਲ ਕੀਤੀ ਜਾਵੇ ਸਕੂਲਾਂ ਦੀ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ ਅਤੇ ਵੱਧ ਤੋਂ ਵੱਧ ਅੰਗਰੇਜ਼ੀ 'ਤੇ ਜ਼ੋਰ ਦਿੱਤਾ ਜਾਂਦਾ ਹੈ ਸਮਝਿਆ ਜਾਂਦਾ ਹੈ ਕਿ ਜਿ ਜੋ ਬੱਚਾ ਸਕੂਲ ਦੇ ਵਿੱਚ ਅੰਗਰੇਜ਼ੀ ਭਾਸ਼ਾ ਬੋਲਦਾ ਹੈ ਉਹੀ ਇੱਕ ਪੜ੍ਹਿਆ ਲਿਖਿਆ ਅਤੇ ਸਹੀ ਬੱਚਾ ਸਮਝਿਆ ਜਾਂਦਾ ਹੈ ਉਸ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ ਸਿਰਫ ਇੱਕ ਪੰਜਾਬੀ ਹੀ ਇੱਕ ਅਜਿਹਾ ਵਿਸ਼ਾ ਹੈ ਜਿਸਨੂੰ ਅਸੀਂ ਪੰਜਾਬੀ ਦੇ ਵਿੱਚ ਬੋਲ ਸਕਦੇ ਹੋਰ ਉਸ ਤੋਂ ਇਲਾਵਾ ਦੂਜੇ ਵਿਸ਼ਿਆਂ ਵਿੱਚ ਪੰਜਾਬੀ ਬੋਲਣ 'ਤੇ ਰੋਕ ਲਗਾਈ ਜਾਂਦੀ ਹੈ ਪੰਜਾਬੀ ਹਰ ਥਾਂ 'ਤੇ ਲਿਖਣ ਤੋਂ ਵੀ ਰੋਕ ਦਿੱਤੀ ਜਾਂਦੀ ਹੈ ਅਤੇ ਚਾਹੇ ਸਾਈਨਬੋਰਡ ਹੋ ਜਾਣ ਸੜਕਾਂ 'ਤੇ ਗੱਲ ਕੀਤੀ ਜਾਵੇ ਸਕੂਲਾਂ ਵਿੱਚ ਹਰੇਕ ਪੱਧਰ ਦੇ ਵਿੱਚ ਪੰਜਾਬੀ ਦੀ ਤਰਜੀਹ ਨੂੰ ਘਟਾਇਆ ਜਾ ਰਿਹਾ ਅਤੇ ਅੰਗਰੇਜ਼ੀ ਨੂੰ ਵਧਾਇਆ ਜਾ ਰਿਹਾ ਹੈ ਦਫਤਰਾਂ ਦੇ ਵਿੱਚ ਵੀ ਚਾਹੇ ਅਸੀਂ ਕਿਤੇ ਇੰਟਰਵਿਊ 'ਤੇ ਜਾ ਰਹੇ ਹਾਂ ਜਾਂ ਅਸੀਂ ਆਪਣੇ ਰਿਸ਼ਤੇਦਾਰ ਦੋਸਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਜਿਹ ਜੋ ਇਨਸਾਨ ਪੰਜਾਬੀ ਬੋਲਦਾ ਹੈ ਅਸੀਂ ਉਹਨਾਂ ਨੂੰ ਘੱਟ ਸਨਮਾਨ ਦਿੰਦੇ ਹਾਂ ਅਸੀਂ ਸੋਚਦੇ ਹਾਂ ਕਿ ਚਾਹੇ ਸ਼ਾਇਦ ਉਹ ਪ ਅਨਪੜ੍ਹ ਬੰਦਾ ਹੈ ਬਟ ਪਰ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਅੰਗਰੇਜ਼ੀ ਭਾਸ਼ਾ ਬੋਲਣ ਵਾਲੇ ਇਨਸਾਨ ਨੂੰ ਹੀ ਅਸੀਂ ਪੜ੍ਹਿਆ ਲਿਖਿਆ ਮੰਨਦੇ ਹਾਂ ਪੰਜਾਬੀ ਵਾਲੇ ਨੂੰ ਨਹੀਂ ਪਰ ਸਾਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ ਅਤੇ ਆਪਣੀ ਭਾਸ਼ਾ ਪੰਜਾਬੀ ਭਾਸ਼ਾ ਨੂੰ ਵਿਕਸਿਤ ਕਰਨਾ ਚਾਹੀਦਾ ਹੈ ਅਤੇ ਅਤ ਅੱਜ ਕੱਲ੍ਹ ਤਾਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਪੰਜਾਬੀ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਸਮਝਿਆ ਜਾਂਦਾ ਹੈ ਕਿ ਪੰਜਾਬੀ ਇੱਕ ਅਜਿਹਾ ਵਿਸ਼ਾ ਹੈ ਜੋ ਸਾਡਾ ਆਉਣ ਵਾਲਾ ਆਉਣ ਵਾਲੀ ਪੀੜੀ ਭੁੱਲਦੀ ਜਾ ਰਹੀ ਹੈ ਅਤੇ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਰਹੀ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਲੋੜ ਹੈ ਆਪਣੀ ਸੋਚ ਨੂੰ ਬਦਲਣ ਦੀ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਇਹ ਸਮਝਾਉਣ ਦੀ ਕਿ ਪੰਜਾਬੀ ਇੱਕ ਅਜਿਹਾ ਖੇਤਰ ਹੈ ਜੋ ਸਾਡੀ ਪੀੜੀਆਂ ਨਾਲ ਜੁੜਿਆ ਹੋਇਆ ਅਤੇ ਸਾਨੂੰ ਆਪਣੀ ਮਿੱਟੀ ਦੇ ਨਾਲ ਹੀ ਜੋੜ ਕੇ ਰੱਖਦਾ ਹੈ ਚਾਹੇ ਅਸੀਂ ਬਾਹਰ ਦੇ ਮੁਲਕ ਵਿੱਚ ਵੀ ਜਾ ਰਹੇ ਹਾਂ ਅਸੀਂ ਉਹਨਾਂ ਦੀ ਅੰਗਰੇਜ਼ੀ ਨੂੰ ਵੀ ਅਪਣਾ ਰਹੇ ਹਾਂ ਪਰ ਸਾਨੂੰ ਫੇਰ ਵੀ ਲੋੜ ਹੈ ਆਪਣੇ ਪੰਜਾਬੀ ਨੂੰ ਨਾ ਭੁੱਲ ਕੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ ਅਤੇ ਵੱਧ ਤੋਂ ਵੱਧ ਪੰਜਾਬੀ ਦਾ ਵਿਕਸਿਤ ਕੀਤਾ ਪੰਜਾਬੀ ਨੂੰ ਵਿਕਾਸ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਪੰਜਾਬੀ ਬੋਲ ਕੇ ਪੜ੍ਹ ਕੇ ਲਿਖ ਕੇ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਜਾਗਰੂਕ ਕਰਵਾਇਆ ਜਾ ਸਕੇ